ਹੈਲੋ ਉਹ ਹਾਂ ਵਈ ਸਨੀ ਕੀ ਹਾਲ ਚਾਲ ਯਾਰ ਤੇਰਾ ਓਏ ਫੋਨ ਯਾਰ ਤੇਰੇ ਕੋਲ ਆਪਣਾ ਸੈਮਸੰਗ ਦਾ ਮੈਂ ਠੀਕ ਕਰਾਇਆ ਸੀਗਾ ਆਹੋ ਅਤੇ ਉਹ ਯਾਰ ਚਲਦਾ ਹੀ ਨਹੀਂ ਸਹੀ ਤਰੀਕੇ ਨਾਲ ਉਹਦੀ ਸਾਰੀ ਨਾ ਟੱਚ ਚੱਜ ਨਾਲ ਚਲਦੀ ਪਈ ਆ ਬਾਰ ਬਾਰ ਹੈਂਗ ਕਰੀ ਜਾ ਰਹੀ ਹੈ ਨਾ ਉਹ ਬੈਕ ਪ੍ਰੋਪਰ ਚੱਜ ਨਾਲ ਹੋ ਰਿਹਾ ਫਾਇਦਾ ਕੀ ਹੈ ਤੁਹਾਡੇ ਕੋਲ ਕੰਮ ਕਰਾਉਣ ਦਾ ਤੁਸੀਂ ਨਹੀਂ ਠੀਕ ਚੱਜ ਨਾਲ ਕਰਕੇ ਦੇਣਾ ਸੀ ਜਾਂ ਪਹਿਲਾਂ ਦੱਸ ਦਿੰਦੇ ਆਪਾਂ ਇੰਨੀ ਸਸਤੀ ਸਕਰੀਨ ਨਾ ਪਵਾਉਂਦੇ ਤੇਰੇ ਕਹਿਣ 'ਤੇ ਮੈਂ ਸਕਰੀਨ ਪਵਾਈ ਹੈ ਫਿਰ ਉਹ ਹਾਲ ਤੂੰ ਉਹ ਤਰ੍ਹਾਂ ਕਹਿ ਦੇ ਵੀ ਭਾਈ ਨਹੀਂ ਭਾਅਜੀ ਇਹ ਮਹਿੰਗੀ ਪਵਾ ਲਈਏ ਜਾਂ ਓਰੀਜਨਲ ਨਹੀਂ ਹੈਗੀ ਤੇ ਓਰੀਜਨਲ ਟਾਈਪ ਹੈ ਤਾਂ ਓਰੀਜਨਲ ਟਾਈਪ ਆਪਾਂ ਪਵਾ ਲੈਂਦੇ ਤਾਂ ਭਾਈ ਵਧੀਆ ਚਲੀ ਜਾਂਦੀ ਸਹੀ ਚਲੀ ਜਾਂਦੀ ਅਤੇ ਤੂੰ ਹੁਣ ਆਪਣੀ ਮਰਜ਼ੀ ਨਾਲ ਮੈਂ ਜਿੱਦਾਂ ਤੈਨੂੰ ਕਿਹਾ ਵੀ ਤੂੰ ਭਾਈ ਆਪਣੇ ਹਿਸਾਬ ਨਾਲ ਪਾ ਦੇ ਅਤੇ ਹੁਣ ਆ ਕਿਸ ਤਰ੍ਹਾਂ ਦੀ ਪਾ ਕੇ ਦਿੱਤੀ ਹੋਈ ਆ ਯਾਰ ਕੋਈ ਇਹਦਾ ਫਾਇਦਾ ਹੀ ਨਹੀਂ ਹੈ ਸਾਰੇ ਫੋਨ ਦੀ ਜੜ੍ਹ ਪੁੱਟ ਕੇ ਰੱਖ ਤੀ ਮੇਰੇ ਦੀ ਮੈਂ ਤਾਂ ਸਿਆਪੇ ਨੂੰ ਫੜਿਆ ਨਾ ਇਹ ਚੱਲੇ ਨਾ ਇਹ ਕਰੇ ਮੈਨੂੰ ਹੁਣ ਤੂੰ ਦੱਸ ਵੀ ਮੈਂ ਇਹਦਾ ਕੀ ਕਰਾਂ ਜਾਂ ਤਾਂ ਮੇਰਾ ਫੋਨ ਦੁਬਾਰਾ ਠੀਕ ਕਰਕੇ ਦੇ ਨਹੀਂ ਇੱਦਾਂ ਫਿਰ ਕਿੱਦਾਂ ਬਣੂਗੀ ਗੱਲ ਨਹੀਂ ਯਾਰ ਮੈਨੂੰ ਨਹੀਂ ਸਮਝ ਆਉਂਦੀ ਇਹ ਫੋਨ ਚੱਲਣ ਦਾ ਫਾਇਦਾ ਹੀ ਫੈਦ ਫਾਇਦਾ ਹੀ ਕੋਈ ਨਹੀਂ ਮੈਨੂੰ ਇਹ 'ਚੋਂ ਫੋਨ ਚਲਾਉਣ ਦਾ ਨਾ ਇਹ ਚੱਜ ਨਾਲ ਚੱਲਦਾ ਪਿਆ ਬਾਰ ਬਾਰ ਹੈਂਗ ਹੋਣ ਡਿਆ ਰਿਪੇਅਰ ਵੀ ਯਾਰ ਰਿਪੇਅਰ ਤੁਸੀਂ ਕਰਨਾ ਤੁਹਾਡਾ ਕੰਮ ਹੈ ਹੁਣ ਮੈਂ ਹੁਣ ਕੀ ਕਰ ਸਕਦਾ ਤੁਹਾਡਾ ਹੁਣ ਚ ਚਾਹੀਦਾ ਵਾ ਬੰਦੇ ਨਾਲ ਗੱਲ ਕਰਨੀ ਵੀ ਕਿੱਦਾਂ ਚੱਲੂਗਾ ਕਿੱਦਾਂ ਨਹੀਂ ਚੱਲੂਗਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੇਰੇ ਵੱਲੋਂ ਜਿਸ ਤਰ੍ਹਾਂ ਮਰਜ਼ੀ ਇਹਨੂੰ ਠੀਕ ਕਰਕੇ ਦਿਓ ਇਹ ਤੁਹਾਨੂੰ ਪਤਾ ਕਿਸ ਤਰ੍ਹਾਂ ਕਰਨਾ ਕਿਸ ਤਰ੍ਹਾਂ ਨਹੀਂ ਕਰਨਾ